ਸਾਡੇ ਸੈਰ ਸਪਾਟਾ ਦੀਆਂ ਕਾਫੀ ਜਗ੍ਹਾ ਹੈਗੀਆਂ ਜਿਵੇਂ ਕਿਲ੍ਹਾ ਮੁਬਾਰਕ ਸਾਹਿਬ ਹੈ ਗੁਰਦੁਆਰਾ ਸਾਹਿਬ ਇਤਿਹਾਸਿਕ ਕਿਲ੍ਹਾ ਹੈਗਾ ਜੋ ਕਿ ਕਾਫੀ ਟਾਈਮ ਤੋਂ ਹੈਗਾ ਬਹੁਤ ਹੀ ਪੁਰਾਣਾ ਹੈਗਾ ਉਹ ਛੋਟੀ ਇੱਟਾਂ ਨਾਲ ਛੋਟੀ ਟਾਈਲ ਨਾਲ ਉਹਦੀ ਬਾਉਂਡਰੀ ਹੋਈ ਵੀ ਆ ਉਹਦੇ ਨਾਲ ਬਣਿਆ ਹੋਇਆ ਹੈਗਾ ਹੋਰ ਜਿਵੇਂ ਕਿ ਮਿੱਤਲ ਮੌਲ ਹੈ ਕਾਫੀ ਪੁਰਾਣਾ ਮੌਲ ਹੈ ਇੱਕ ਮੌਲ ਤਾਂ ਬਿੱਗ ਮੌਲ ਤਾਂ ਬੰਦ ਹੋ ਗਿਆ ਸੀ ਮਿੱਤਲ ਮੌਲ ਹੈ ਉਹ 'ਚ ਕਾਫੀ ਸ਼ੋਪਿੰਗ ਲਈ ਵੀ ਕੁਛ ਖਰੀਦਣ ਲਈ ਕੱਪੜੇ ਕੋਈ ਉਹ ਵੀ ਕਾਫੀ ਦੁਕਾਨਾਂ ਹੈਗੀਆਂ ਹਨ ਉੱਥੇ ਅਤੇ ਹੋਰ ਵੀ ਕਾਫੀ ਜਿਵੇਂ ਕਿ ਸਿਰਕੀ ਬਾਜ਼ਾਰ 'ਚ ਕਾਫੀ ਕੱਪੜੇ ਦੀਆਂ ਦੁਕਾਨਾਂ ਹੈ ਅਤੇ ਜਿੰਦਲ ਕਲੋਥ ਹਾਊਸ ਹੈ ਮੈਂ ਉੱਥੋਂ ਕੱਪੜੇ ਲੈਂਦਾ ਹੁੰਦਾ ਹੈਗਾ ਅਤੇ ਬੂਟ ਮੈਂ ਇਸ ਵਾਰ ਸਾਡੇ ਜੋਧਪੁਰ ਰੋਡ 'ਤੇ ਇੱਕ ਨਵਾਂ ਸ਼ੋਅਰੂਮ ਖੁੱਲ੍ਹਿਆ ਗਾ ਰੀਬੋਕ ਦਾ ਮੈਂ ਉੱਥੋਂ ਲੈ ਕੇ ਆਇਆ ਸੀਗਾ ਉਹ ਵੀ ਵਧੀਆ ਨਿਕਲੇ ਖਾਣ ਪੀਣ ਦਾ ਵੀ ਕਾਫੀ ਹੈਗੀਆਂ ਜਿਵੇਂ ਸ਼ਾਮ ਢਾਬਾ ਅਤੇ ਔਲਖ ਰੈਸਟੋਰੈਂਟ ਹੈ ਉੱਥੇ ਵੀ ਕਾਫੀ ਸੁਆਦਲਾ ਖਾਣਾ ਮਿਲਦਾ ਗਾ